ਹੈਲੋ ਖਾਲਸਾ ਟੂਰ ਐਂਡ ਟਰੈਵਲਰ ਤੋਂ ਬੋਲਦੇ ਆ ਜੀ ਮੈਂ ਨਰੇਸ਼ ਧੌਲ ਪੱਤਰਕਾਰ ਗੱਲ ਕਰ ਰਿਹਾ ਜੀ ਹਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਕ ਕਿਰਾਏ 'ਤੇ ਗੱਡੀ ਚਾਹੀਦੀ ਹੈ ਜੀ ਹਾਂ ਛੇ ਸੱਤ ਮੈਂਬਰ ਹੋਣਗੇ ਜੀ ਉਹਦਾ ਕਿਆ ਹਿਸਾਬ ਹੁੰਦਾ ਜੀ ਕਿਲੋਮੀਟਰਾਂ ਕਿਲੋਮੀਟਰਾਂ ਦੇ ਹਿਸਾਬ ਨਾਲ ਹੁੰਦਾ ਹੈ ਜਾ ਕੇ ਦਿਹਾੜੀ ਦੇ ਹਿਸਾਬ ਨਾਲ ਜੀ ਹਾਂਜੀ ਹਾਂ ਦੋ ਦਿਨ ਲਈ ਚਾਹੀਦੀ ਆ ਜੀ ਬਲਾਚੌਰ ਤੋਂ ਮਨੀਕਰਨ ਸਾਹਿਬ ਜਾਣਾ ਹੈ ਹਾਂ ਠੀਕ ਹੈ ਸਰ ਬੁੱਕ ਕਰ ਦਿਓ ਜੀ ਅਤੇ ਫਿਰ ਆਪਾਂ ਕੱਲ੍ਹ ਨੂੰ ਆ ਕੇ ਲੈ ਜਾਂਦੇ ਹਾ ਹਾਂ ਧੰਨਵਾਦ ਜੀ ਥੈਂਕ ਯੂ ਜੀ